ਹਾਂਜੀ ਹੁਣ ਮੇਰੇ ਕੋਲ ਇਹ ਜਿਹੜੀ ਹੈਗੀ ਹੈ ਧਾਰਮਿਕ ਬੁੱਕ ਮੈਂ ਸਭ ਤੋਂ ਪਹਿਲਾਂ ਉਹ ਇਸਕੋਨ ਵਰਿੰਦਾਵਨ ਗਈ ਅਤੇ ਉੱਥੇ ਸਟੋਲ ਲੱਗਾ ਹੋਇਆ ਸੀ ਅਤੇ ਸਟੋਲ ਦੇ ਉੱਤੋਂ ਮੈਂ ਬੁੱਕ ਖਰੀਦੀ ਭਗਵਤ ਗੀਤਾ ਉਹ ਮੈਨੂੰ ਕਾਫ਼ੀ ਇੰਸਪਾਇਰ ਕਰਦੀ ਆ ਔਰ ਸਾਨੂੰ ਆਪਣੀਆਂ ਧਾਰਮਿਕ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਤਾਂ ਆਪਣੇ ਧਰਮ ਨਾਲ ਜੁੜੇ ਰਹਿਣਾ ਚਾਹੀਦਾ ਔਰ ਅਸੀਂ ਤਾਂ ਹੀ ਜੁੜੇ ਰਹਾਂਗੇ ਜੇ ਅਸੀਂ ਉਹਨਾਂ ਨੂੰ ਪੜ੍ਹਾਂਗੇ ਜਾਂ ਉਹਨਾਂ ਨੂੰ ਫੋਲੋ ਵੀ ਕਰਾਂਗੇ ਜੋ ਜ਼ਿਆਦਾਤਰ ਲੋਕੀਂ ਫੋਲੋ ਨਹੀਂ ਕਰਦੇ ਸਿਰਫ਼ ਪੜ੍ਹ ਲੈਂਦੇ ਆ ਪੜ੍ਹ ਕੇ ਅਤੇ ਚਲੋ ਰੱਖ ਦਿੱਤੀ ਪਰ ਇਹ ਚੀਜ਼ਾਂ ਦੀ ਸਾਡੇ ਜ਼ਿੰਦਗੀ ਵਿੱਚ ਕਾਫ਼ੀ ਇੰਪੋਟੈਂਸ ਹੈਗੀ ਹੈ ਤਾਂ ਸਾਨੂੰ ਇਹਦੀ ਇੰਪੋਟੈਂਸ ਕਦੀ ਭੁੱਲਣੀ ਨਹੀਂ ਚਾਹੀਦੀ ਜੋ ਵੀ ਸ਼੍ਰੀ ਕ੍ਰਿਸ਼ਨ ਜੀ ਦੇ ਉਪਦੇਸ਼ ਹੈ ਉਹ ਅੱਜ ਵੀ ਇੰਪਲੀਮੈਂਟ ਹੋ ਰਹੇ ਹੈ ਕਲਯੁੱਗ ਦੇ ਨਾਲ ਵੀ ਰਿਲੇਟ ਕਰਦੇ ਹੈ ਉਹਨਾਂ ਨੇ ਉਪ ਉਸ ਤੋਂ ਕਾਫ਼ੀ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਪ੍ਰੋਬਲਮ ਆਉਣਗੀਆਂ ਅਤੇ ਇਹ ਜੇ ਪ੍ਰੋਬਲਮ ਆਉਣਗੀਆਂ ਅਤੇ ਅਸੀਂ ਇਹ ਪ੍ਰੋਬਲਮ ਨੂੰ ਅਸੀਂ ਇਸ ਤਰ੍ਹਾਂ ਟੈਕਲ ਕਰਨਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਸੌ ਗਲਤੀਆਂ ਵੀ ਕਿਸੇ ਦੀਆਂ ਮਾਫ਼ ਕਰ ਸਕਦੇ ਪਰ ਇੱਕ ਜਿਹੜੀ ਇੱਕ ਸੌ ਇੱਕ ਗਲਤੀ ਹੈਗੀ ਆ ਫਿਰ ਉਹ ਦੁਬਾਰਾ ਨਹੀਂ ਉਹਨਾਂ ਦੀ ਉਹ ਗਲਤੀਆਂ ਅਸੀਂ ਮਾਫ਼ ਕਰਨੀਆਂ ਇੱਕ ਗਲਤੀ ਜੇ ਉਹਨੇ ਵੱਧ ਕਰਤੀ ਸੌ ਤੋਂ ਵੱਧ ਤਾਂ ਉਹ ਗਲਤੀ ਅਸੀਂ ਉਹਨੂੰ ਮਾਫ਼ ਨਹੀਂ ਕਰਨੀ ਅਤੇ ਉਹ ਉਹਨਾਂ ਨੂੰ ਫਿਰ ਅਸੀਂ ਵੀ ਜੇ ਸਾਡੇ ਨਾਲ ਕੋਈ ਧਰਮ ਨਹੀਂ ਨਿਭਾ ਰਿਹਾ ਅਸੀਂ ਵੀ ਆਪਣਾ ਸਾਨੂੰ ਧਰਮ ਆਪਣਾ ਛੱਡ ਕੇ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣੀ ਪੈਣੀ ਹੈ ਅਸੀਂ ਕੋਈ ਬਹੁਤ ਅਨਿਆਏ ਨਹੀਂ ਸਹਿ ਸਕਦੇ ਅਤੇ ਸਾਨੂੰ ਉਹਨਾਂ ਦੇ ਵਿਰੁੱਧ ਆਵਾਜ਼ ਉਠਾ ਕੇ ਇਹਦਾ ਮੁਕਾਬਲਾ ਕਰਨਾ ਹੀ ਪੈਣਾ